ਸਥਾਨਕ ਕਲਾਕਾਰ ਕਈ ਤਰੀਕੇ ਅਪਣਾਉਂਦੇ ਹਨ ਜਿਸ ਨਾਲ ਆਪਣੇ ਸਥਾਨ ਅਤੇ ਰਾਜ ਦੀ ਕਲਾ ਅਤੇ ਸਭਿਆਚਾਰ ਨੂੰ ਵਧਾਇਆ ਜਾ ਸਕੇ ਜਿਵੇਂ ਕਿ ਅਸੀਂ ਦਵਾਰਾਂ 'ਤੇ ਕੋਈ ਵੀ ਅਗਰ ਕੁਛ ਦੱਸਣਾ ਹੈਗਾ ਏ ਕਿਸੇ ਨੂੰ ਕੁਛ ਉਸ ਬਾਰੇ ਸਮਝਾਉਣਾ ਹੈਗਾ ਅਸੀਂ ਦੀਵਾਰ 'ਤੇ ਉਹਦੇ ਉੱਤੇ ਪੇਂਟਿੰਗ ਕਰਦੇ ਹਾਂ ਇਹਦੇ ਵੱਡੇ ਵੱਡੇ ਪੋਸਟਰ ਬਣਾਏ ਜਾਂਦੇ ਹਨ ਸਕੂਲਾਂ ਕਾਲਜਾਂ ਦੇ ਵਿੱਚ ਵੀ ਅਗਰ ਬੱਚਿਆ ਨੂੰ ਕੁਛ ਸਮਝਾਉਣਾ ਪਵੇ ਅਤੇ ਇਸਦੀ ਪੇਂਟਿੰਗ ਅਸੀਂ ਧਰਤੀ ਦੇ ਉੱਤੇ ਦੀਵਾਰਾਂ ਦੇ ਉੱਤੇ ਜਾਂ ਕਈ ਬੋਡਸ ਦੇ ਉੱਪਰ ਵੀ ਇਹ ਬਣਾ ਸਕਦੇ ਹਾਂ ਇਹਦੇ ਬਹੁਤ ਹੀ ਅੱਛੇ ਸਾਨੂੰ ਲਾਭ ਦੇਖਣ ਨੂੰ ਮਿਲਦੇ ਹਨ ਕਿ ਬੱਚੇ ਇਸ ਨਾਲ ਬਹੁਤ ਜਲਦੀ ਸਿੱਖਣ ਦੇ ਹਨ ਬੱਚੇ ਕਿਆ ਵੱਡੇ ਵੀ ਬਹੁਤ ਜਲਦੀ ਹੀ ਸਿੱਖਦੇ ਹਨ